ਹੈਲੋ ਹਾਂਜੀ ਮੈਮ ਜੀ ਨਮਸਕਾਰ ਹਾਂਜੀ ਹਾਂਜੀ ਹਾਂਜੀ ਕਿਸ ਸਟੇਜ 'ਤੇ ਹਾਂਜੀ ਜ਼ਰੂਰ ਬੋਲੋ ਹਮ ਹਮ ਮੈਮ ਐਗਰੀਕਲਚਰ ਸੈਕਟਰ ਵਿੱਚ ਸਾਡਾ ਜਿਹੜਾ ਮਤਲਬ ਇਕੋਨਮੀ ਆ ਉਹ 'ਤੇ ਕਾਫੀ ਜ਼ਿਆਦਾ ਫੈਕਟ ਪੈ ਰਿਹਾ ਜਿੱਦਾਂ ਕਿ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਜੇ ਸਾਡੇ ਮਤਲਬ ਪੰਜਾਬ ਵਿੱਚ ਕਾਫੀ ਜ਼ਿਆਦਾ ਕਿਸਾਨ ਹੈ ਅਤੇ ਸਰਕਾਰ ਨੇ ਵੀ ਕਿਸਾਨਾਂ ਦੀ ਭਲਾਈ ਲਈ ਕਾਫੀ ਜ਼ਿਆਦਾ ਸਕੀਮਜ਼ ਜਿਹੜੀ ਹੈ ਉਹ ਚਲਾਈਆਂ ਹੋਈਆਂ ਜਿਹਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਆ ਰਿਹਾ ਇਸੇ ਤਰ੍ਹਾਂ ਸਾਡੀ ਇਕਨੋਮੀ ਜਿਹੜੀ ਆ ਕਾਫੀ ਜ਼ਿਆਦਾ ਸਟਰੋਂਗ ਹੋ ਰਹੀ ਹੈ ਅਤੇ ਆਉਣ ਵਾਲੇ ਟਾਈਮ 'ਚ ਵੀ ਇੱਦਾਂ ਹੀ ਸਰਕਾਰ ਕਰੇਗੀ

ਹਮ ਹਮ ਮੋਸਟ ਵੈਲਕਮ ਮੈਮ ਹਾਂਜੀ ਹਾਂਜੀ ਓਕੇ ਓਕੇ ਵੈਲਕਮ